ਹਾਂਜੀ ਸੋ ਪੰਜਾਬ ਸੁਲ ਸਿੱਖਿਆ ਕਾਫੀ ਡਿਵੈਲਪ ਹੋ ਗਈ ਹੈ ਹੁਣ ਕਾਫੀ ਚੇਂਜਿਸ ਆ ਗਈਆਂ ਅਤੇ ਦੋ ਤਰ੍ਹਾਂ ਦੀਆਂ ਆਪਣੇ ਪੰਜਾਬ ਸਿੱਖਿਆ ਪ੍ਰਣਾਲੀ ਪ੍ਰਾਈਮਰੀ ਐਂਡ ਸਕੈਂਡਰੀ ਹੁਣ ਜਿਹੜੇ ਕਲਾਸਰੂਮ ਹੈ ਸਮਾਰਟ ਰੂਮ 'ਚ ਚੇਂਜ ਹੋ ਗਏ ਹੈ ਅਤੇ ਲੈਬਸ ਹੋ ਗਈਆਂ ਅਤੇ ਬੱਚਿਆਂ ਨੂੰ ਕਾਫੀ ਸਿੱਖਣ ਨੂੰ ਮਿਲ ਰਿਹਾ ਸੀ ਜੋ ਕਿ ਪਹਿਲਾਂ ਅਸੀਂ ਨਹੀਂ ਦੇਖਦੇ ਸੀ ਬਟ ਹੁਣ ਕਾਫੀ ਮੋਡਰਨਾਈਜੇਸ਼ਨ ਹੋਇਆ ਅਤੇ ਸਾਡੀ ਸਰਕਾਰ ਨੂੰ ਇਹਦਾ ਸਰੇਅ ਜਾਂਦਾ ਹੈ ਜੋ ਕਿ ਬਹੁਤ ਚੰਗੀ ਗੱਲ ਹੈ ਹੁਣ ਬੱਚੇ ਈਵਨ ਕਈ ਮਾਪੇ ਆਪਣੇ ਬੱਚੇ ਕੱਢ ਕੇ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲਾਂ ਲਗਾ ਰਹੇ ਕਿਉਂਕਿ ਫੀਸ ਵੀ ਘੱਟ ਹੈ ਅਤੇ ਹੋਰ ਫੈਸਿਲਿਟੀ ਜਿੱਦਾਂ ਬ ਬੁੱਕਸ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਜੋ ਕਿ ਚੰਗੀ ਗੱਲ ਹੈ ਅਤੇ ਕਿਉਂਕਿ ਬੇ ਪ੍ਰਾਈਵੇਟ ਸਕੂਲ ਕਾਫੀ ਮਹਿੰਗੇ ਐਕਸਪੈਂਸਿਸ ਹੋ ਗਏ ਹੈ ਤਾਂ ਇਹ ਚੰਗਾ ਮੂਵ ਹੈ ਵੀ ਬੱਚਿਆਂ ਲਈ ਲਾਇਬਰੇਰੀਜ ਵੀ ਹੈ ਪਲੇਗਰਾਉਂਡ ਵੀ ਹੈ ਖੇਡਣ ਨੂੰ ਵੀ ਹੈ ਅਤੇ ਸੈਮੀਨਾਰ ਵੀ ਕਰਵਾਏ ਜਾ ਰਹੇ ਹੈ ਜੋ ਕਿ ਬੜੀ ਵਧੀਆ ਗੱਲ ਹੈ ਅਤੇ ਆਈ ਥਿੰਕ ਹੁਣ ਪੱਧਰ ਕਾਫੀ ਉੱਚਾ ਹੋ ਚੁੱਕਿਆ ਪੰਜਾਬ ਸ